ਆਉਣ ਵਾਲੇ ਸਾਲਾਂ ਵਿੱਚ ਮੇਰੇ ਉਦਯੋਗ ਤੇ ਕੁਛ ਤਕਨੀਕੀ ਕਾਡਾਂ ਦਾ ਗਹਿਰਾ ਪ੍ਰਭਾਵ ਹੋ ਸਕਦਾ ਹੈ ਇਹਨਾਂ ਵਿੱਚ ਕੁਝ ਮਹੱਤਵਪੂਰਨ ਤਕਨੀਕਾਂ ਸ਼ਾਮਿਲ ਹੋ ਸਕਦੀਆਂ ਹਨ ਆਰਗੂਮੈਂਟ ਰੈਲਟੀ ਏਆਰ ਕਿਸੇ ਵੀ ਖੇਤਰ ਵਿੱਚ ਅਜਿਹੀਆ ਨਵੀਆਂ ਗਤੀਵਿਧੀਆਂ ਦਾ ਸਿਰ ਸਰੰਜਣ ਕਰ ਸਕਦੀ ਹੈ ਜਿਵੇਂ ਕਿ ਸਿੱਖਿਆ ਦਵਾਈ ਅਤੇ ਖੇਡ ਇਹ ਉਪਭੋਗਤਾ ਨੂੰ ਇੱਕ ਨਵਾਂ ਤਜਰਬਾ ਪ੍ਰਦਾਨ ਕਰਦੀ ਹੈ ਜਿੱਥੇ ਉਹ ਆਵਾਜ਼ ਰਵੀਜਵਲ ਓਲੀਮੈਂਟਸ ਦੁਬਾਰਾ ਖਾਸ ਸਮੱਗਰੀ ਨੂੰ ਅਸਲੀ ਜਗ੍ਹਾ ਤੇ ਵੇਖ ਸਕਦੇ ਹਾਂ ਨਿਊ ਐਨਰਜੀ ਸਲਿਊਸ਼ਨ ਨਵੀਨ ਤਾਕਤ ਦੇ ਹਲ ਜਿਵੇਂ ਕਿ ਸੂਰਜੀ ਊਰਜਾ ਹਵਾਈ ਊਰਜਾ ਵਾਟਰ ਕੰਡਕਸ਼ਨ ਤਕਨੀਕਾਂ ਉਦਯੋਗਾਂ ਵਿੱਚ ਹਰ ਰੋਜ ਦੀ ਬਿਜਲੀ ਦੀ ਖਪਤ ਨੂੰ ਘਟਾ ਸਕਦੀਆਂ ਹਨ ਅਤੇ ਵਾਤਾਵਰਣ ਲਈ ਲਾਭਕਾਰੀ ਹੋ ਸਕਦੀਆਂ ਹਨ ਇਹ ਸੰਸਾਰ ਦੇ ਵੱਡੇ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਐਮਪੀ ਐਨ ਐਲ ਪੀ ਸਹੀ ਤਰੀਕੇ ਨਾਲ ਭਾਸ਼ਾ ਨੂੰ ਸਮਝਣ ਅਤੇ ਪ੍ਰਕਿਰਿਆ ਕਰਨ ਵਿੱਚ ਵੱਧ ਰੁਚੀ ਪ੍ਰਗਟ ਕਰ ਰਿਹਾ ਹੈ ਇਹ ਚੈਟ ਨੋਟਾਂ ਵਿੱਚ ਗੁਨ ਵਰਤਦਾ ਰਾਹੀਂ ਸਵਾਦਾਂ ਲਈ ਵਿਸ਼ਾ ਸੰਭਾਵਨਾਵਾਂ ਖੋਲਦਾ ਹੈ ਇਹਨਾਂ ਤਕਨੀਕਾਂ ਨਾਲ ਮਸ਼ੀਨਰੀ ਮਨੁੱਖ ਭਾਸ਼ਾ ਨਾਲ ਵਧੀਆ ਇੰਟਰ ਐਜੂਕੇਸ਼ਨ ਕਰ ਸਕਦੀ ਹੈ ਇਸ ਨਾਲ ਸੇਵਾ ਖੇਤਰਾਂ ਵਿੱਚ ਨਵੀਨਤਾ ਅਤੇ ਉੱਚੀ ਕੁਆਲਿਟੀ ਪ੍ਰਦਾਨ ਹੋ ਸਕਦੀਆਂ ਹਨ ਇਹਨਾਂ ਤਰੀਕਾਂ ਦਾ ਵਧੇਰਾ ਵਿਕਾਸ ਅਤੇ ਯੋਗ ਉਦਯੋਗਾਂ ਨੂੰ ਉਹਨਾਂ ਦੇ ਕਾਰਜਕਾਰੀ ਦ੍ਰਿਸਟੀਕੋਨ ਵਿੱਚ ਕਾਫੀ ਬਦਲਾਅ ਨਾਲ ਸਾਮ ਸਾਹਮਣਾ ਕਰਵਾਏਗਾ